ਮੇਰੀ ਇਹ ਸੋਚ ਹੈ ਕਿ ਸਕੂਲੀ ਪੜ੍ਹਾਈ ਤੋਂ ਬਾਅਦ ਸਾਰੇ ਵਿਦਿਆਰਥੀ ਜਿਹੜੇ ਨੇ ਉਸ ਉੱਚ ਸਿੱਖਿਆ ਪ੍ਰਾਪਤ ਨਹੀਂ ਕਰਦੇ ਕੁਝ ਵਿਦਿਆਰਥੀ ਅਜਿਹੇ ਹਨ ਜੋ ਆਪਣੇ ਪਰਿਵਾਰਕ ਕਾਰੋਬਾਰ ਨੂੰ ਅੱਗੇ ਵਧਾਉਂਦੇ ਨੇ ਅਤੇ ਕੁਝ ਅਜਿਹੇ ਵੀ ਵਿਦਿਆਰਥੀ ਨੇ ਜੋ ਨੌਕਰੀ ਵਗੈਰਾ ਕਰਨ ਦੇ ਵਿੱਚ ਦਿਲਚਸਪੀ ਰੱਖਦੇ ਨੇ ਅਤੇ ਉਹ ਉਸ ਲਾਈਨ ਦੇ ਵਿੱਚ ਜਾਂਦੇ ਨੇ ਤਾਂ ਇਸ ਤਰ੍ਹਾਂ ਸਾਰੇ ਵਿਦਿਆਰਥੀ ਸਕੂਲੀ ਪੜ੍ਹਾਈ ਤੋਂ ਬਾਅਦ ਉੱਚੀ ਵਿੱਦਿਆ ਜਾਂ ਉੱਚ ਸਿੱਖਿਆ ਪ੍ਰਾਪਤ ਨਹੀਂ ਕਰਦੇ